ਲਗਭਗ ਸਾਰੇ ਹੀ ਅਖਬਾਰ ਵਧੀਆ ਹਨ ਪਰ ਮੇਰਾ ਵਧੇਰੇ ਮਨ ਪਸੰਦ ਅਖਬਾਰ ਪੰਜਾਬੀ ਟ੍ਰਿਬਿਊਨ ਹੈ ਇਸ ਵਿੱਚ ਵਰਤਮਾਨ ਵਿੱਚ ਆਉਣ ਵਾਲੀਆਂ ਖਬਰਾਂ ਅਤੇ ਉਸ ਸਬੰਧੀ ਘਟਨਾਵਾਂ ਨੂੰ ਵਧੇਰੇ ਖੁੱਲ੍ਹ ਕੇ ਪੇਸ਼ ਕੀਤਾ ਜਾਂਦਾ ਹੈ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਆਉਣ ਵਾਲੇ ਸਾਹਿਤਕ ਰਸਾਲਿਆਂ ਜਾਂ ਸਾਹਿਤਕ ਪੁਸਤਕਾਂ ਦਾ ਰਿਵਿਊ ਦਿੱਤਾ ਜਾਂਦਾ ਹੈ ਜੋ ਕਿ ਵਧੇਰੇ ਲਾਹੇਵੰਦ ਹੁੰਦਾ ਹੈ ਸਾ ਅਖ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਸਾਹਿਤ ਸਬੰਧੀ ਹੋਰ ਵਧੇਰੇ ਕਵਿਤਾਵਾਂ ਕਹਾਣੀਆਂ ਛਪਦੀਆਂ ਹਨ ਜੋ ਨਵੇਂ ਲੇਖਕਾਂ ਵੱਲੋਂ ਕੀਤੀਆਂ ਛਾਪੀਆਂ ਅਤੇ ਕੀਤੀਆਂ ਜਾਂਦੀਆਂ ਹਨ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਵਰਤਮਾਨ ਦੇ ਮੁੱਦੇ ਅਤੇ ਉਹਨਾਂ ਦੇ ਉੱਪਰ ਹੋਈਆਂ ਡਿਬੇਟਾਂ ਜਾਂ ਉਹਨਾਂ ਮੁੱਦਿਆਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਜੋ ਆਮ ਤੋਂ ਆਮ ਇਨਸਾਨ ਬੰਦਾ ਵੀ ਸਮਝ ਸਕਦਾ ਹੈ ਅ